ਹੈਲੋ ਹਾਂਜੀ ਨਮਸਕਾਰ ਹਾਂਜੀ ਹਾਂਜੀ ਇੱਥੇ ਇੱਕ ਤਾਂ ਜੀ ਪ੍ਰਤਾਪ ਬਾਗ ਹੈਗਾ ਇੱਕ ਕਰੋੜਵੰਸ਼ ਪਾਰਕ ਹੈਗਾ ਅਬੋਹਰ ਰੋਡ 'ਤੇ ਉਸੇ ਤਰ੍ਹਾਂ ਇੱਧਰ ਦੇਖਣ ਵਾਲਾ ਹੋਰ ਹੈਗਾ ਇੱਕ ਫੌਜੀਆਂ ਦੀ ਸਮਾਧ ਉੱਥੇ ਬੜਾ ਵੱਡਾ ਪਾਰਕ ਉਸ ਤੋਂ ਥੋੜ੍ਹਾ ਜਿਹਾ ਅੱਗੇ ਚਲੇ ਜਾਓਗੇ ਤਾਂ ਬਾਰਡਰ 'ਤੇ ਚਲੇ ਜਾਓ ਬਾਰਡਰ 'ਤੇ ਫੌਜੀਆਂ ਦੀ ਪਰੇਡ ਉੱਥੇ ਬੈਠਣ ਵਾਸਤੇ ਉੱਥੇ ਛੋਟੇ ਜਿਹੇ ਉਹਨਾਂ ਨੇ ਨਵੇਂ ਨਵੇਂ ਪਾਰਕ ਬਣਾਏ ਨੇ ਉੱਥੇ ਤੁਸੀਂ ਜਾ ਸਕਦੇ ਜੇ ਬਾਕੀ ਸਾਡੇ ਬਾਰਡਰ ਇੱਥੋਂ ਪੈ ਜਾਂਦੇ ਦਸ ਕੁ ਕਿਲੋਮੀਟਰ 'ਤੇ ਤੁਸੀਂ ਜਾ ਪਾਕਿਸਤਾਨ ਦਾ ਬਾਰਡਰ ਹੈ ਜੀ ਇਹ ਹਾਂ ਉੱਥੇ ਪਰੇਡ ਰੋਜ਼ ਰਾਤ ਨੂੰ ਦਿਖਾਈ ਜਾਂਦੀ ਹੈ ਔਰ ਉਹ ਜਿਹੜਾ ਗਾਰਡਨ ਹੈ ਉਹ ਸ਼ਾਮ ਨੂੰ ਫੌਜੀਆਂ ਦੇ ਵਾਸਤੇ ਸਮਾਧੀ ਬਣੀ ਉੱਥੇ ਲੋਕ ਦਰਸ਼ਨ ਕਰਨ ਜਾਂਦੇ ਨੇ ਉੱਥੇ ਵੀ ਜਾਇਆ ਜਾ ਸਕਦਾ ਅਤੇ ਹੋਰ ਲੇਟੈਸਟ ਇਹ ਕਿ ਸਾਡੇ ਫਾਜ਼ਿਲਕਾ ਦਾ ਰੇਲਵੇ ਸਟੇਸ਼ਨ ਬਹੁਤ ਅੱਛਾ ਬਣਾ ਤਾ ਸਰਕਾਰ ਨੇ ਉਹਦੇ ਅੱਗੇ ਵੀ ਪਾਰਕ ਬਹੁਤ ਅੱਛੇ ਬਣਾ ਦਿੱਤੇ ਨੇ ਛੋਟੇ ਲੋਕ ਵੈਸੇ ਜਾ ਕੇ ਉੱਥੇ ਬੈਠਦੇ ਨੇ ਰਾਤੀ ਸ਼ਾਮ ਨੂੰ ਵੀ ਗੱਪ ਸ਼ੱਪ ਕਰਦੇ ਨੇ ਅਤੇ ਨਹੀਂ ਇਹਦਾ ਐਕਚੁਲੀ ਨਾਮ ਪ੍ਰਤਾਪ ਨਹੀਂ ਹੈਗਾ ਇਹਦਾ ਨਾਂ ਹੈ ਪ੍ਰਤਾਵ ਵੈ ਨਾਲ ਉਹ ਇੱਥੇ ਜਿਹੜੇ ਹਾਂ ਜਾਟ ਬਰਾਦਰੀ ਦੇ ਲੋਕ ਸੀ ਉਹਨਾਂ ਦਾ ਉਹ ਵਿਗੜ ਕੇ ਹੁਣ ਪ੍ਰਤਾਪ ਹੀ ਬਣ ਗਿਆ ਕਿਸੇ ਨੂੰ ਇਹ ਸ਼ਬਦ ਦਾ ਪਤਾ ਨਹੀਂ ਇਸ ਕਰਕੇ ਹੁਣ ਉੱਥੇ ਲਿਖਿਆ ਵੀ ਇਹੀ ਜਾਂਦਾ ਪ੍ਰਤਾਪ ਬਾਗ ਐਕਚੁਲੀ ਸ਼ੁਰੂ ਤੋਂ ਪ੍ਰਤਾਪ ਬਾਗ ਸੀ ਉਸ ਤੋਂ ਬਾਅਦ ਰਾਜੀਵ ਗਾਂਧੀ ਪਾਰਕ ਰੱਖਤਾ ਲੇਕਿਨ ਲੋਕਾਂ ਨੇ ਇਤਰਾਜ ਕੀਤਾ ਵੀ ਜਿਹਨਾਂ ਨੇ ਪੈਸੇ ਖਰਚੇ ਨੇ ਉਹਨਾਂ ਦਾ ਨਾਂ ਤਾਂ ਤੁਸੀਂ ਮਿਟਾ ਤਾ ਦੁਬਾਰਾ ਫਿਰ ਉਹ ਪ੍ਰਤਾਪ ਪਰਸਨ ਸੀ ਜਾਟ ਬਰਾਦਰੀ ਦਾ ਸੀ ਉਹਨਾਂ ਨੇ ਪੈਸੇ ਕਮੇਟੀ ਨੂੰ ਦਾਨ ਕੀਤੀ ਸੀ ਇਹ ਜਗ੍ਹਾ 'ਤੇ ਉਸ ਤਰ੍ਹਾਂ ਹੀ ਬਣਾਇਆ ਸੀ ਹਾਂਜੀ

ਇਸ ਤੋਂ ਇਲਾਵਾ ਕਿਉਂਕਿ ਸ਼ਹਿਰ ਬਹੁਤ ਬਹੁਤ ਵੱਡਾ ਤਾਂ ਨਹੀਂ ਹੈਗਾ ਲੇਕਿਨ ਜਿੰਨਾ ਵੀ ਏ ਵੀ ਇੱਥੇ ਦੇਖਣ ਵਾਲੀਆਂ ਨੇ ਚਾਰੇ ਦਿਸ਼ਾਵਾਂ 'ਚ ਮੰਦਰ ਅੱਛੇ ਨੇ ਮੰਦਿਰਾਂ ਦੇ ਵਿੱਚ ਵੀ ਛੋਟੇ ਛੋਟੇ ਪਾਰਕ ਬਣੇ ਨੇ ਉੱਥੇ ਵੀ ਲੋਕ ਬੈਠਦੇ ਨੇ ਅਤੇ ਚਾਰ ਦਿਸ਼ਾਵਾਂ ਕਿਉਂਕਿ ਇੱਕ ਸਾਈਡ ਦਾ ਬਾਰਡਰ ਲੱਗ ਜਾਂਦਾ ਇਸ ਕਰਕੇ ਸ਼ਹਿਰ ਛੋਟਾ ਰਹਿ ਗਿਆ ਅਗਰ ਸ਼ਹਿਰ ਦਸ ਪੰਦਰ੍ਹਾਂ ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ